ਪੰਜਾਬ ਵਿੱਚ ਕਿਹੜੀਆਂ ਪ੍ਰਮੁੱਖ ਕਾਰੋਬਾਰੀ ਘਟਨਾਵਾਂ ਜਾਂ ਕਾਨਫਰੰਸਾਂ ਹਨ ਜੋ ਉੱਦਮੀਆਂ ਨਿਵੇਸ਼ਕਾਂ ਅਤੇ ਉਦਯੋਗ ਪੇਸ਼ੇਵਾਰਾਂ ਨੂੰ ਇਕੱਠੇ ਕਰਦੀਆਂ ਹਨ ਪੰਜਾਬ ਦੀ ਪ੍ਰਮੁੱਖ ਕਾਰੋਬਾਨੀ ਘਟਨਾਵਾਂ ਪੰਜਾਬ ਦੀ ਆਰਥਿਕ ਹਾਲਾਤ ਅਤੇ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਘਟਨਾਵਾਂ ਹਨ ਇਹ ਕੁਝ ਮਹੱਤਵਪੂਰਨ ਘਟਨਾਵਾਂ ਹਨ ਹਰਾ ਬਣਾ ਹਰਾ ਪਾਣੀ ਅੰਦੋਲਨ ਪੰਜਾਬ ਭਾਰਤ ਦਾ ਪਹਿਲਾ ਰਾਜ ਸੀ ਜਿੱਥੇ ਹਰੀ ਕ੍ਰਾਂਤੀ ਦਾ ਸਭ ਤੋਂ ਵੱਡਾ ਅਸਰ ਹੋਇਆ ਐਗਰੀਕਲਚਰ ਅ ਦੀ ਵੱਧਦੀ ਉਤਪੱਤਾ ਨਾਲ ਖੇਤੀਬਾੜੀ 'ਤੇ ਅਧਾਰਿਤ ਵਪਾਰ ਵੱਧ ਗਏ ਐਮ ਐਸ ਪੀ ਦਾ ਲਾਭ ਮਿਲਣ ਲੱਗਾ ਉੱਨੀ ਸੌ ਚੁਰਾਸੀ ਦਾ ਦੰਗਾ ਅਤੇ ਆਰਥਿਕ ਅਸਰ ਉੱਨੀ ਸੌ ਚੁਰਾਸੀ ਦੇ ਸਿੱਖ ਦੰਗੇ ਕਾਰਨ ਪੰਜਾਬ ਦੀ ਇਕਨੋਮੀ ਨੂੰ ਵੱਡਾ ਝਟਕਾ ਲੱਗਾ ਕਾਰੋਬਾਰੀ ਹਾਲਾਤ ਮੰਦੇ ਹੋ ਗਏ ਬਹੁਤ ਸਾਰੇ ਉਦਯੋਗ ਬੰਦ ਹੋ ਗਏ ਬਹੁਤ ਸਾਰੇ ਪੰਜਾਬੀਆਂ ਬਿਜਨਸਮੈਨ ਵਿਦੇਸ਼ ਚੱਲੇ ਗਏ ਤੀਜਾ ਉੱਨੀ ਸੌ ਇਕਾਨਵੇਂ ਦਾ ਆਰਥਿਕ ਸੁਧਰ ਸੁਧਾਰ ਭਾਰਤ ਦੇ ਬਾਜ਼ਾਰ ਪ੍ਰੀਵੈਲੀਟੀਵੀਟਾਈਜੇਸ਼ਨ ਲਿਬਰੀਜੇਸ਼ਨ ਅਤੇ ਗਲੋਬੀਜੇਸ਼ਨ ਦੇ ਕਾਰਨ ਖੁੱਲ੍ਹ ਗਏ ਪ੍ਰਾਈਵੇਟ ਸੈਕਟਰ ਦੇ ਨਏ ਵੇ ਨਵੇਂ ਵਪਾਰ ਪੰਜਾਬ ਵਿੱਚ ਆਏ ਪਰ ਜ਼ਿਆਦਾ ਇੰਡਸਟਰੀਅਲ ਵਿਕਾਸ ਨਾ ਹੋ ਸਕੇ ਚੌਥਾ ਉੱਨੀ ਸੌ ਨੱਬੇ ਤੋਂ ਦੋ ਹਜ਼ਾਰ ਤੱਕ ਪੰਜਾਬੀ ਉਦਯੋਗ ਅਤੇ ਕਾਰੋਬਾਰ ਦਾ ਵਿਕਾਸ ਲੁਧਿਆਣਾ ਹੋਜਰੀ ਸਾਈਕਲ ਇੰਡਸਟਰੀ ਅਤੇ ਸਪੋਰਟਸ ਗੁਡ ਸਕੈਚ ਮੈਨੂਫੈਕਚਰਿੰਗ ਦਾ ਹਬ ਬਣ ਗਿਆ ਜਲੰਧਰ ਦਾ ਸਰਜੀਕਲ ਇੰਸਟਰੂਮੈਂਟਸ ਅਤੇ ਸਪੋਰਟਸ ਇੰਡਸਟਰੀ ਫੇਮਸ ਹੋ ਗਈ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਵਾਪਸ ਉੱਠਦੀ ਪੰਜਵਾਂ ਦੋ ਹਜ਼ਾਰ ਬਾਅਦ ਖੇਤੀ ਦਾ ਸੰਕਟ ਅਤੇ ਕਾਰੋਬਾਰੀ ਹਾਲਾਤ ਖੇਤ ਵਿੱਚ ਐਮ ਐਸ ਪੀ 'ਤੇ ਨਿਰਭਰਤਾ ਵੱਧ ਗਈ ਪਰ ਕਰਜ਼ ਦੀ ਸਮੱਸਿਆ ਵੱਧ ਗਈ ਭੂ ਮਾਫ਼ੀ ਕਲਚਰ ਅਤੇ ਕਾਰਪੋਰੇਟ ਫਾਰਮਿੰਗ ਵੱਧ ਗਏ ਪੰਜਾਬ ਵਿੱਚ ਨਵੇਂ ਸਟਾਰਟਅਪਸ ਦਾ ਟਰੈਂਡ ਵੱਧਣ ਲੱਗਾ